ਹਾਂਜੀ ਮੇਰੇ ਕੋਲ ਇੱਕ ਵਿਸ਼ੇਸ਼ ਹੁਨਰ ਹੈ ਪੜ੍ਹਾਉਣ ਦਾ ਮੈਂ ਇੱਕ ਅਧਿਆਪਕ ਹਾਂ ਹਰ ਰੋਜ਼ ਹੀ ਇਸ ਹੁਨਰ ਦੇ ਨਾਲ਼ ਮੈਂ ਖੁਦ ਵੀ ਸਿੱਖਦੀ ਹਾਂ ਅਤੇ ਵਿਦਿਆਰਥੀਆਂ ਨੂੰ ਵੀ ਸਿਖਾਉਂਦੀ ਹਾਂ ਇਸ ਰੋਜ਼ ਦੇ ਸਿੱਖਣ ਸਿਖਾਉਣ ਦੇ ਕਿਰਿਆ ਕ੍ਰਮ ਦੇ ਨਾਲ ਜਿਹੜੀ ਜ਼ਿੰਦਗੀ ਹੈ ਇਹਦੇ ਵਿੱਚ ਇੱਕ ਨਵੀਂ ਰੁਸ਼ਨਾਈ ਆਉਂਦੀ ਆ